ਹੈਲੋ ਸਤਿ ਸ਼੍ਰੀ ਅਕਾਲ ਸਾਰੇ ਸ਼ਹਿਰ ਦੇ ਸ ਸਤਿ ਸ਼੍ਰੀ ਅਕਾਲ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪ੍ਰਿੰਸ ਬੇਕਰੀ ਜਿਹੜੀ ਕਿ ਬਹੁਤ ਹੀ ਵਧੀਆ ਬੇਕਰੀ ਹੈ ਅੰਮ੍ਰਿਤਸਰ ਦੀ ਮੰਨੀ ਪ੍ਰਮੰਨੀ ਹੋਈ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਹ ਬਿਲਕੁਲ ਸ਼ਹੀਦਾਂ ਸਾਹਿਬ ਗੁਰਦੁਆਰਾ ਦੇ ਨਾਲ ਅੰਦਰ ਜਾਂਦੀ ਰੋਡ 'ਤੇ ਉੱਪਰ ਸਥਿਤ ਹੈ ਬਹੁਤ ਹੀ ਲੋਕ ਇਹਨਾਂ ਕੋਲ ਆਉਂਦੇ ਹਨ ਬਹੁਤ ਹੀ ਭੀੜ ਰਹਿੰਦੀ ਹੈ ਅਸੀਂ ਤੁਹਾਨੂੰ ਆਪਣੇ ਇੱਕ ਕਸਟਮਰ ਨਾਲ ਵੀ ਗੱਲ ਕਰਾਉਣੀ ਚਾਹਾਂਗੇ ਜਿਹੜੇ ਕਿ ਇੱਥੋਂ ਬਹੁਤ ਆਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਤੁਸੀਂ ਆਪਣਾ ਨਾਮ ਦੱਸੋ ਕੀ ਹੈ ਠੀਕ ਹੈ ਮਨਪ੍ਰੀਤ ਕੌਰ ਜੀ ਤੁਸੀਂ ਅਕਸਰ ਇੱਥੇ ਪ੍ਰਿੰਸ ਬੇਕਰੀ 'ਤੇ ਆਉਂਦੇ ਜੇ ਜੀ ਜੀ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਅਸੀਂ ਤੁਹਾਨੂੰ ਦਿਖਾਉਣਾ ਚਾਹਵਾਂਗੇ ਮੈਂ ਆਪਣੇ ਛੋਟੇ ਵੀਰ ਕੈਮਰੇ ਵਾਲੇ ਨੂੰ ਕਹਾਂਗਾ ਕਿ ਉਹ ਜ਼ਰਾ ਕੈਮਰਾ ਇੱਧਰ ਵੀ ਦਿਖਾਵੇ ਦੇਖੋ ਕਿੰਨੇ ਸੋਹਣੇ ਸੋਹਣੇ ਅਤੇ ਕਿੰਨੇ ਪਿਆਰੇ ਪਿਆਰੇ ਕੇਕ ਇਨ੍ਹਾਂ ਨੇ ਸਜਾਏ ਹੋਏ ਨੇ ਹੋਰ ਹੋਰ ਕੀ ਤੁਸੀਂ ਮਨਪ੍ਰੀਤ ਜੀ ਪ੍ਰਿੰਸ ਬੇਕਰੀ ਬਾਰੇ ਮਨਪ੍ਰੀਤ ਜੀ ਹੋਰ ਕੀ ਕੀ ਇੱਥੇ ਮਿਲਦਾ ਹੋਰ ਇਹਨਾਂ ਦੀ ਸ਼ੋਪ 'ਤੇ ਪ੍ਰਿੰਸ ਬੇਕਰੀ 'ਤੇ ਕੀ ਕੀ ਮਿਲਦਾ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਬਿਲਕੁਲ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਸ ਬੇਕਰੀ ਬਹੁਤ ਹੀ ਮੰਨੀ ਪ੍ਰਮੰਨੀ ਹੋਈ ਹਾਂਜੀ ਹਾਂਜੀ ਪ੍ਰਮੰਨੀ ਹੋਈ ਬੇਕਰੀ ਸ਼ੋਪ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੇ ਬਿਸਕਿਟ ਬੇਕਰੀ ਵਾਲੇ ਨੇ ਕੱਪ ਕੇਕਸ ਪੇਸਟਰੀਆਂ ਬਹੁਤ ਹੀ ਟੇਸਟੀ ਔਰ ਬਹੁਤ ਹੀ ਦੇਖਣ ਵਿੱਚ ਹੀ ਬਹੁਤ ਫਰੈਸ਼ ਔਰ ਬਹੁਤ ਹੀ ਅਚਮ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਆਪਣੇ ਵੀਰਾਂ ਅਤੇ ਭੈਣਾਂ ਨੂੰ ਕਿ ਤੁਸੀਂ ਇੱਕ ਵਾਰੀ ਪ੍ਰਿੰਸ ਬੇਕਰੀ 'ਤੇ ਜ਼ਰੂਰ ਆਉ ਇੱਕ ਵਾਰੀ ਜ਼ਰੂਰ ਇਹਨਾਂ ਕੋਲੋਂ ਕੇਕ ਵਗੈਰਾ ਬਣਵਾਓ ਅਤੇ ਟੇਸਟ ਕਰੋ ਬਹੁਤ ਬਹੁਤ ਧੰਨਵਾਦ ਜੀ